ਨਵਾਂਸ਼ਹਿਰ ਦੇ ਵਿੱਚ ਤਾਂ ਇੱਦਾਂ ਦੇ ਬਹੁਤ ਸਾਰੀਆਂ ਜਿਹੜੀਆਂ ਕਲਾ ਹੈ ਜਿਹੜੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਜਿੱਦਾਂ ਕਿ ਇੱਥੇ ਰਾਹੋਂ ਦਾ ਪਾਰਕ ਹੈ ਰਾਹੋਂ ਦੇ ਪਾਰਕ ਦੇ ਵਿੱਚ ਜਿਹੜਾ ਇੱਕ ਕਲਾਕਾਰ ਹੈ ਉਹਨਾਂ ਨੇ ਪੁਰਾਣਾ ਸਮਾਨ ਜਿੱਦਾਂ ਪੁਰਾਣੇ ਜਿਹੜੇ ਟਰੱਕਾਂ ਦੇ ਟਾਇਰ ਨੇ ਹੈ ਨਾ ਬੱਸਿਸ ਦੇ ਟਾਇਰ ਨੇ ਜਾਂ ਹੋਰ ਜਿਹੜੇ ਪੁਰਾਣੇ ਫਟੇ ਕੱਪੜੇ ਆ ਉਹਨਾਂ ਤੋਂ ਬਹੁਤ ਸਾਰੀਆਂ ਜਿਹੜੀਆਂ ਕਲਾਕਾਰੀ ਦਿਖਾ ਦਿਖਾ ਕੇ ਬਹੁਤ ਸਾਰੀਆਂ ਚੀਜ਼ਾਂ ਬਣਾ ਬਣਾ ਕੇ ਲਾਈਆਂ ਹੋਈਆਂ ਨੇ ਜਿੱਦਾਂ ਕਿ ਜਿਹੜੇ ਟਰੱਕ ਦੇ ਟਾਇਰ ਨੇ ਉਹਨਾਂ ਤੋਂ ਉਨ੍ਹਾਂ ਨੇ ਬੈਂਚ ਬਣਾਏ ਹੋਏ ਨੇ ਪਾਰਕਾਂ ਦੇ ਵਿੱਚ ਜਿਹੜੇ ਪੁਰਾਣੇ ਕੱਪੜੇ ਹੈ ਉਹਨਾਂ ਦੀਆਂ ਮੂਰਤੀਆਂ ਜੀਆਂ ਬਣਾ ਬਣਾ ਕੇ ਹੈ ਨਾ ਇੱਕ ਸਟੈਚੂ ਬਣਾ ਬਣਾ ਕੇ ਜਿਹੜੇ ਉੱਥੇ ਕਿ ਪਾਰਕ ਦੇ ਵਿੱਚ ਲਾਏ ਨੇ ਜਿਹੜੇ ਕਿ ਦੇਖਣ ਨੂੰ ਵੀ ਬਹੁਤ ਜ਼ਿਆਦਾ ਪਿਆਰੇ ਲੱਗਦੇ ਨੇ ਅਤੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹ ਵੀ ਕੰਮ ਦੇ ਵਿੱਚ ਆ ਜਾਂਦੀਆਂ ਨੇ ਅਤੇ ਜਿਹੜਾ ਪਲਾਸਟਿਕ ਵੇਸਟ ਹੈ ਉਹ ਵੀ ਘੱਟ ਹੁੰਦਾ ਹੈ